ਹੈਲੋ

ਹਾਂਜੀ ਹਾਂਜੀ ਮੈਂ ਬਲਕਾਰ ਬੋਲ ਰਿਹਾ ਹੁਣ ਦੀਆਂ ਸੀਜਨਲ ਤਾਂ ਆਪਣੇ ਕੋਲ ਸਾਰੀਆਂ ਸਬਜ਼ੀਆਂ ਹੈਗੀਆਂ ਜੀ ਫੁੱਲ ਗੋਭੀ ਵੀ ਆ ਪੱਤਾ ਗੋਭੀ ਵੀ ਆ ਟਮਾਟਰ ਆ ਭਿੰਡੀ ਤੋਰੀ ਕੱਦੂ ਸਭ ਕੁਛ ਮਿਲ ਜਾਏਗਾ ਜੀ ਭਿੰਡੀ ਆਪਣੇ ਕੋਲ ਜੀ ਦੋਵੇਂ ਤਰੀਕੇ ਦੀ ਆਈ ਔਰਗੈਨਿਕ ਭਿੰਡੀ ਵੀ ਆ ਅਤੇ ਦੂਜੀ ਵੀ ਜਿਹੜੀ ਔਰਗੈਨਿਕ ਭਿੰਡੀ ਆ ਜੀ ਉਹ ਹੈਗੀ ਆ ਸੌ ਰੁਪਏ ਕਿੱਲੋ ਅਤੇ ਦੂਜੀ ਸਸਤੀ ਮਿਲ ਜਾਏਗੀ ਜੀ ਤੁਹਾਨੂੰ ਹਾਂਜੀ ਹਾਂਜੀ ਉਹ ਅਸੀਂ ਆਪ ਹੀ ਤਿਆਰ ਕਰਦੇ ਉਹਦੀ ਫੁੱਲ ਗਰੰਟੀ ਆ ਕੋਈ ਦਵਾਈ ਵੀ ਨਹੀਂ ਵਿੱਚ ਆਉਂਦੀ ਤੁਹਾਨੂੰ ਕੱਦੂ ਦਾ ਤਾਂ ਹੁਣ ਥੋੜ੍ਹਾ ਸਸਤਾ ਹੀ ਚੱਲ ਰਿਹਾ ਠੀਕ ਹੀ ਚੱਲ ਰਿਹਾ ਜੀ ਵੀਹ ਕੁ ਰੁਪਏ ਕਿੱਲੋ ਆ ਜੀ

ਹਾਂਜੀ ਹਾਂਜੀ ਪਿਆਜ਼ ਵੀ ਹੈਗਾ ਜੀ ਨਾਸਿਕ ਵਾਲਾ ਪਿਓਰ ਪਿਆਜ਼ ਆ ਜੀ ਪਿਆਜ਼ ਜੇਕਰ ਪੰਜ ਕਿੱਲੋ ਲੈਣਾ ਤਾਂ ਸੌ ਰੁਪਏ ਆ ਜੀ ਅਤੇ ਜੇ ਕਿੱਲੋ ਦੇ ਹਿਸਾਬ ਨਾਲ ਲਓਗੇ ਤਾਂ ਪੱਚੀ ਰੁਪਏ ਕਿੱਲੋ ਲੱਗ ਜਾਏਗਾ ਹਾਂਜੀ ਹਾਂਜੀ ਹਾਂਜੀ ਮੈਂ ਦੁਕਾਨ 'ਤੇ ਹੀ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ

ਅੱਧਾ ਕਿੱਲੋ ਟਮਾਟਰ ਵੀ ਭਿੰਡੀ ਕਿਹੜੀ ਕਰਨੀ ਆ ਜੀ ਤੁਸੀਂ ਔਰਗੈਨਿਕ ਜਾਂ ਦੂਜੀ ਠੀਕ ਹੈ ਜੀ ਉਹੀ ਕਰ ਹਾਂਜੀ ਹਾਂਜੀ ਮਿਰਚਾਂ ਵੀ ਹੈਗੀਆਂ ਹਰੀਆਂ ਮਿਰਚਾਂ ਅਚਾਰ ਵਾਲੀਆਂ ਵੀ ਆ ਅਤੇ ਦੂਜੀਆਂ ਵੀ ਠੀਕ ਹੈ ਠੀਕ ਹੈ ਜੀ ਠੀਕ ਹੈ ਜ਼ਰੂਰ ਕੁੱਲ ਤਿੰਨ ਸੌ ਪੈਂਤੀ ਰੁਪਏ ਬਣ ਗਏ ਜੀ ਕੁੱਲ ਠੀਕ ਹੈ ਜੀ ਅੱਛਾ ਘਰ ਪਹੁੰਚਾ ਦਿੰਦਾ ਠੀਕ ਆ ਜੀ ਉਹ ਆਪਣਾ ਬੰਦਾ ਆ ਜਾਊਗਾ ਨਾ ਇੱਥੇ ਲ ਅ ਲੈ ਜਾਊਗਾ ਜਾਂ ਮੈਂ ਆਪਣਾ ਬੰਦਾ ਭੇਜ ਦੇਵਾਂ ਇੱਧਰੋਂ ਠੀਕ ਆ ਗੇਟ 'ਤੇ ਫਿਰ ਉਨ੍ਹਾਂ ਨੂੰ ਕਹਿ ਦਿਓ ਮੈਂ ਨਾ ਦਸਾਂ ਪੰਦਰਾਂ ਮਿੰਟਾਂ ਤੱਕ ਹੀ ਭੇਜ ਦੂੰਗਾ ਜੀ ਠੀਕ ਹੈ ਜੀ ਠੀਕ ਹੈ